ਟੈਕਨੋਲਜੀ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਕਿ ਸਾਡੇ ਇੰਜੀਨੀਅਰ ਦੇ ਵਿਦਿਆਰਥੀਆਂ ਨੇ ਇਸ ਨੂੰ ਲੱਭਿਆ ਹੈ ਟੈਕਨੋਲਜੀ ਨਾਲ ਸਿਰਫ ਬੈਂਕਿੰਗ ਹੀ ਨਹੀਂ ਬਾਕੀ ਜਗ੍ਹਾ ਵੀ ਬਹੁਤ ਫਾਇਦਾ ਹੋਇਆ ਹੈ ਬੈਂਕ ਵਿੱਚ ਵੀ ਇਹਦਾ ਕਾਫੀ ਫਾਇਦਾ ਹੋਇਆ ਹੈ ਕਿਉਂਕਿ ਜਿਹੜੇ ਬੈਂਕ ਦੇ ਕਰਮਚਾਰੀ ਹਰ ਚੀਜ਼ ਨੂੰ ਹੱਥੀਂ ਲਿਖਦੇ ਸੀ ਅਤੇ ਉਸਨੂੰ ਬਾਅਦ 'ਚੋਂ ਲੱਭ ਲੱਭ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਸੀ ਉਹਦੇ ਤੋਂ ਉਹਨਾਂ ਨੂੰ ਕਾਫੀ ਨਿਜ਼ਾਤ ਮਿਲੀ ਹੈ ਅਤੇ ਉਸ ਨਾਲ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਟਾਈਮ ਜਿਹੜਾ ਸਮਾਂ ਹੈ ਉਹ ਵੱਧ ਗਿਆ ਹੈ ਅਤੇ ਉਸ ਨਾਲ ਉਸਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਵੀ ਹੋਇਆ ਹੈ ਇੱਕ ਤੁਹਾਨੂੰ ਉਦਾਹਰਣ ਦਿੰਦਾ ਹਾਂ ਕਿ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਬੈਂਕ ਵਿੱਚ ਜਾਂਦੇ ਸੀ ਉਹ ਆਪਣੀ ਕਿਤਾਬ ਕੱਢ ਕੇ ਉਹਦੇ 'ਤੇ ਸਾਡੀ ਐਂਟਰੀਆਂ ਪਾਉਂਦੇ ਸੀ ਠੀਕ ਹੈ ਜੀ ਪਰ ਹੁਣ ਉੱਥੇ ਕੰਪਿਊਟਰ ਦੇ ਨਾਲ ਇੱਕ ਐਂਟਰੀ ਕਰਨ ਨਾਲ ਸਭ ਕੁਝ ਪਤਾ ਲੱਗ ਜਾਂਦਾ ਹੈ ਅਤੇ ਉਹਨਾਂ ਨੂੰ ਬਾਰ ਬਾਰ ਕਿਤਾਬਾਂ ਨਹੀਂ ਕੱਢਣੀਆਂ ਪੈਂਦੀਆਂ ਉਹ ਤੁਹਾਡਾ ਖਾਤਾ ਨੰਬਰ ਵਿੱਚ ਪਾ ਕੇ ਉਸ ਤੋਂ ਸਭ ਕੁਝ ਤੁਹਾਨੂੰ ਦੱਸ ਦਿੰਦੇ ਨੇ ਅਤੇ ਉਹਨਾਂ ਦਾ ਕੰਮ ਸੌਖਾ ਹੋ ਗਿਆ ਹੈ ਇਸ ਕਰਕੇ ਬੈਂਕ ਵਿੱਚ ਜਾ ਕੇ ਤੁਸੀਂ ਪਾਸਬੁੱਕ ਦੀ ਐਂਟਰੀ ਵੀ ਹੁਣ ਜਿਹੜੀ ਨਹੀਂ ਟੈਕਨੋਲਜੀ ਆਈ ਹੈ ਪਾਸਬੁੱਕ ਮਸ਼ੀਨਾਂ ਰਾਹੀਂ ਕਰਵਾ ਸਕਦੇ ਹੋ ਇਸ ਨਾਲ ਇਸ ਟੈਕਨੋਲਜੀਆਂ ਨਾਲ ਕਾਫੀ ਤੁਹਾਡਾ ਸਮਾਂ ਵੀ ਬਚਦਾ ਹੈ ਅਤੇ ਕੰਮ ਵੀ ਵਧੀਆ ਤਰੀਕੇ ਨਾਲ ਹੋ ਰਿਹਾ ਹੈ